ਥੋੜੇ ਦਿਨ ਪਹਿਲਾਂ ਮੈਂ ਔਨਲਾਈਨ ਕ੍ਰੋਕਰੀ ਦਾ ਸਮਾਨ ਮੰਗਾਇਆ ਸੀ ਤੇ ਜਿਸ ਵਿੱਚ ਇੱਕ ਜੱਗ ਤੇ ਇੱਕ ਗਲਾਸ ਦਾ ਸੈੱਟ ਸੀ ਇਹ ਦੋਨੋਂ ਪ੍ਰੋਡਕਟ ਮੇਰੇ ਟੁੱਟੇ ਹੋਏ ਨਿਕਲੇ ਸੀ ਜਿਨ੍ਹਾਂ ਨੂੰ ਮੈਂ ਰਿਟਰਨ ਕੀਤਾ ਕਿਉਂਕੀ ਮੈਨੂੰ ਇਹ ਦੋਵੇਂ ਚੀਜਾਂ ਸਹੀ ਨਹੀਂ ਲੱਗੀਆਂ ਐਸ ਦੋਵੇਂ ਸਮਾਨ ਮੈਂ ਐਮਾਜ਼ੋਨ ਤੋਂ ਮੰਗਾਏ ਸੀ